ਹੁਣ ਦੇ ਸਮੇਂ ਵਿੱਚ ਸਾਡੇ ਸ਼ਹਿਰ ਵਿੱਚ ਆਵਾਜਾਈ ਦੀਆਂ ਸਹੂਲਤਾਂ ਬਹੁਤ ਹੀ ਵਧੀਆ ਹਨ ਇੱਥੋਂ ਦੀਆਂ ਸੜਕਾਂ ਸਾਫ਼ ਸੁਥਰੀਆਂ ਅਤੇ ਪੱਕੀਆਂ ਹਨ ਸਰਕਾਰ ਨੇ ਹਰ ਇੱਕ ਸਹੂਲਤ ਇਸ ਸ਼ਹਿਰ ਨੂੰ ਦਿੱਤੀ ਹੋਈ ਹੈ ਅਤੇ ਮੇਰਾ ਹੁਣ ਤੱਕ ਕਿਸੇ ਵੀ ਚੁਣੌਤੀ ਦਾ ਚੁਣੌਤੀ ਨਾਲ ਸਾਹਮਣਾ ਨਹੀਂ ਹੋਇਆ ਅਤੇ ਮੈਂ ਬਹੁਤ ਖੁਸ਼ ਹਾਂ